ਪੰਜਾਬ ਵਿੱਚ ਅਸੀਂ ਰਹਿੰਦੇ ਹਾਂ ਜਿੱਥੇ ਇੱਥੇ ਬਹੁਤ ਤਰ੍ਹਾਂ ਦੇ ਤਿਉਹਾਰ ਦੇ ਪਰੰਪਰਾਗਤ ਸਮਾਗਮ ਹੁੰਦੇ ਹਨ ਜਿਹਨਾਂ ਵਿੱਚ ਆਪਣੇ ਪੰਜਾਬ ਦੀ ਸ਼ੁਰੂਆਤ ਲੋਹੜੀ ਤੋਂ ਹੁੰਦੀ ਹੈ ਲੋਹੜੀ ਮੁਕਤਸਰ ਵਿੱਚ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਇੱਥੇ ਮਾਘੀ ਦਾ ਮੇਲਾ ਲੱਗਦਾ ਹੈ ਅਤੇ ਬਹੁਤ ਦੂਰੋਂ ਨੇੜਿਓਂ ਸੰਗਤਾਂ ਇੱਥੇ ਆਉਂਦੀਆਂ ਹਨ ਅਤੇ ਪੰਜਾਬ ਵਿੱਚ ਹੋਲੀ ਦੇ ਤਿਉਹਾਰ ਨੂੰ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇੱਥੇ ਹੋਲਾ ਮਹੱਲੇ ਨੂੰ ਅਨੰਦਪੁਰ ਸਾਹਿਬ ਵਿੱਚ ਅਸੀਂ ਮਨਾਨੇ ਹਾਂ ਜਿੱਥੇ ਆਪਣੀ ਦੂਰੋਂ ਨੇੜੋਂ ਅਤੇ ਬਾਹਰੋਂ ਵੀ ਬਹੁਤ ਸੰਗਤਾਂ ਹੋਲੇ ਮਹੱਲੇ ਦੀ ਰੌਣਕ ਨੂੰ ਅਤੇ ਉੱਥੋਂ ਦੇ ਇਤਿਹਾਸ ਨੂੰ ਨਿਹੰਗ ਸਿੰਘਾਂ ਦੇ ਕਰਤੱਬਾਂ ਨੂੰ ਦੇਖਣ ਨੂੰ ਉੱਥੇ ਆਨੰਦ ਅਨ ਅਨੰਦਪੁਰ ਸਾਹਿਬ ਪਹੁੰਚਦੇ ਹਨ ਅਤੇ ਵਿਸਾਖੀ ਦਾ ਜੋੜ ਮੇਲਾ ਜਿਹੜਾ ਇਹ ਤਲਵੰਡੀ ਸਾਬੋ ਬਠਿੰਡਾ ਜ਼ਿਲ੍ਹੇ ਵਿੱਚ ਲੱਗਦਾ ਹੈ ਇੱਥੇ ਵੀ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਹਨ ਅਤੇ ਬੜੀ ਧੂਮਧਾਮ ਨਾਲ ਵਿਸਾਖੀ ਦਾ ਤਿਉਹਾਰ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਵਿਸਾਖੀ ਤੋਂ ਬਾਅਦ ਆਪਣੇ ਦਿਵਾਲੀ ਵੇਲੇ ਜੋ ਹੈ ਤਿਉਹਾਰ ਉਹ ਅੰਮ੍ਰਿਤਸਰ ਦੀਵਾ ਦੀ ਦਿਵਾਲੀ ਪੰਜਾਬ ਵਿੱਚ ਕਿ ਹਰ ਜਗ੍ਹਾ ਬਹੁਤ ਮਸ਼ਹੂਰ ਹੈ ਜਿਸ ਵਿੱਚ ਹਿੰਦੁਸਤਾਨ ਤੋਂ ਵੀ ਬਾਹਰੋਂ ਵੀ ਬਹੁਤ ਸੰਗਤਾਂ ਦਿਵਾਲੀ ਅੰਮ੍ਰਿਤਸਰ ਵਿਖੇ ਵੇਖਣ ਵਾਸਤੇ ਆਉਂਦੀਆਂ ਹਨ ਇਸ ਤੋਂ ਬਾਅਦ ਆਪਣੇ ਇਤਿਹਾਸ ਵਿੱਚ ਸਿੱਖ ਇਤਿਹਾਸ ਦੇ ਜੋ ਸ਼ਹੀਦੀ ਜੋੜ ਮੇਲਾ ਉਹ ਜੋ ਫਤਿਹਗੜ੍ਹ ਸਾਹਿਬ ਮਨਾਇਆ ਜਾਂਦਾ ਹੈ ਇੱਥੇ ਆਪਣੇ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਦੇ ਜੋ ਸਾਰਾ ਪਰਿਵਰ ਸ਼ਹੀਦ ਹੋਇਆ ਸੀ ਉਸ ਨੂੰ ਮਨਾਉਣ ਵਾਸਤੇ ਲੋਕ ਇਕੱਤਰ ਹੁੰਦੇ ਹਨ ਜੋ ਕਿ ਬੜੀ ਨਿਮਰਤਾ ਨਾਲ ਅਤੇ ਬਾਣੀ ਨੂੰ ਪੜ੍ਹਦੇ ਹੋਏ ਹਰ ਵੇਲੇ ਬਾਣੀ ਨੂੰ ਪੜ੍ਹਦੇ ਹੋਏ ਮਨਾਇਆ ਜਾਂਦਾ ਹੈ ਇਸ ਤਰ੍ਹਾਂ ਆਪਣੇ ਸਿੱਖ ਇਤਿਹਾਸ ਅਤੇ ਜੋ ਤਿਉਹਾਰ ਅਤੇ ਸਮਾਗਮ ਹਨ ਪੰਜਾਬ ਵਿੱਚ ਮਨਾਏ ਜਾਂਦੇ ਹਨ ਇਹਨਾਂ ਵਿੱਚ ਆਪਣੀਆਂ ਸੰਗਤਾਂ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ ਜੋ ਕਿ ਸਭ ਨੂੰ ਮਨਾਉਣੇ ਵੀ ਚਾਹੀਦੇ ਹਨ ਇਸ ਤਰ੍ਹਾਂ ਆਪਣਾ ਸਿੱਖ ਇਤਿਹਾਸ ਅੱਗੇ ਵੱਧਦਾ ਹੈ ਅਤੇ ਜਿੰਦਾ ਵੀ ਰਹਿੰਦਾ ਹੈ